ਹੈਲੋ ਹਾਂਜੀ ਸ਼ਾਨ ਏ ਪੰਜਾਬ 'ਚੋਂ ਬੋਲਦੇ ਹੋ ਅੱਛਾ ਜੀ ਅਤੇ ਤੁਹਾਡੇ ਕੋਲ ਕੀ ਕੀ ਇਹ ਹੈਗੀ ਹੈ ਜੀ ਪੰਜਾ ਪੰਜਾ ਪੰਜਾਬੀ ਪਕਵਾਨ ਕਿਹੜੇ ਕਿਹੜੇ ਹੈਗੇ ਜੀ ਹਾਂਜੀ ਕੀ ਕੀ ਹੁੰਦੇ ਆ ਅੱਛਾ ਜੀ ਅੱਛਾ ਜੀ ਠੀਕ ਤੇ ਹੋਰ ਕੀ ਹੁੰਦਾ ਹੈ ਅੱਛਾ ਜੀ ਅੱਛਾ ਜੀ ਹਾਂ ਜੁਆਕ ਕਹਿੰਦੇ ਸੀ ਅਸੀਂ ਸ਼ਿਮਲਾ ਘੁੰਮਣ ਜਾਂਦੇ ਸੀ ਜਵਾਕ ਕਹਿੰਦੇ ਬਈ ਅਸੀਂ ਰੋਟੀ ਖਾਣੀ ਆ ਤਾਂ ਨਾ ਰੋਟੀ ਖਾ ਲਈਏ ਕਹਿੰਦਾ ਤਾਂ ਪੁੱਛਦੇ ਸੀ ਅੱਛ ਅੱਛ ਅੱਛਾ ਜੀ ਅਤੇ ਹੋਰ ਕੀ ਕੀ ਹੁੰਦਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਤੰਦੂਰੀ ਚਿਕਨ ਵੀ ਹੁੰਦਾ ਅੱਛਾ ਜੀ ਅਤੇ

ਅੱਛਾ ਜੀ ਅੱਛਾ ਚਲੋ ਛੋਲੇ ਭਟੂਰੇ ਇਹ ਵੀ ਹੁੰਦੇ ਜੀ ਅੱਛਾ ਜੀ

ਅੱਛਾ ਆਉਂਦੇ ਹਾਂ ਜੀ

ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਮੱਖਣ ਹੁੰਦਾ ਘਰ ਦਾ ਮੱਖਣ ਹੁੰਦਾ ਕੇ ਮਿਲਾਵਟ ਹੁੰਦਾ ਜੀ ਅੱਛਾ ਜੀ ਚੰਗਾ ਜੀ ਅੱਛਾ ਜੀ ਆਪ ਹੀ ਕਰਦੇ ਹੋ ਅੱਛਾ ਜੀ ਅੱਛਾ ਜੀ

ਅੱਛਾ ਸਾਫ਼ ਸੁਥਰਾ ਰੱਖਦੇ ਸਫ਼ਾਈ ਰੱਖਦੇ ਹੋ ਮਤਲਬ ਅੱਛਾ ਜੀ ਚਲੋ ਮੈਂ ਆਉਂਦੇ ਹਾਂ ਜੀ ਠੀਕ ਹੈ ਜੀ ਆਉਂਦੇ ਹਾਂ ਜੀ ਠੀਕ ਹੈ ਜੀ ਆਉਂਦੇ